ਅਲੱਗ ਅਲੱਗ ਮੌਸਮ ਦੇ ਹਿਸਾਬ ਨਾਲ਼ ਸਾਡੇ ਅਲੱਗ ਅਲੱਗ ਤਰੀਕੇ ਨਾਲ਼ ਕੱਪੜੇ ਧੋਏ ਜਾਂਦੇ ਹਨ ਜਿੱਦਾਂ ਗਰਮੀਆਂ ਵਿੱਚ ਸਾਨੂੰ ਐਨੀ ਗਰਮੀ ਮਸ਼ੀਨ ਲਾਉਣ ਦੀ ਲੋੜ ਵਰਤੋਂ ਦੀ ਲੋੜ ਨਹੀਂ ਪੈਂਦੀ ਆ ਇਸ ਕਰਕੇ ਅਸੀਂ ਆਪਣੀ ਬਾਲਟੀ 'ਚ ਕੱਪੜੇ ਡੁਬੋ ਕੇ ਸਰਫ਼ ਵਿੱਚ ਡੁਬੋ ਕੇ ਥਾਪੜੀ ਨਾਲ਼ ਧੋਂਦੇ ਸਾਬਣ ਲਾਉਂਦੇ ਹਾਂ ਫਿਰ ਅਸੀਂ ਇਹਨੂੰ ਦੋ ਪਾਣੀ 'ਚ ਕੱਢ ਕੇ ਸੁਕਾ ਕੇ ਤਾਰ ਪਰ ਜਾਂ ਕੋਠੇ ਪਰ ਸੁੱਕਣੇ ਪਾਉਂਦੇ ਹਾਂ ਫਿਰ ਉਹਨੂੰ ਤਾਰ ਪਰ ਉੱਪਰ ਤੋਂ ਲਿਆ ਕੇ ਤਹਿ ਲਾ ਕੇ ਪ੍ਰੈੱਸ ਕਰਕੇ ਅਲ ਅਲਮਾਰੀ 'ਚ ਰੱਖਦੇ ਹਾਂ ਫਿਰ ਜਿੱਦਾਂ ਇਹ ਬਰਸਾਤ ਵਿੱਚ ਬਾਹਰ ਵਰਖਾ ਹੋਣ ਕਾਰਨ ਅਸੀਂ ਕਦੇ ਕਦੇ ਧੁੱਪ ਚੜ੍ਹੀ ਹੁੰਦੀ ਆ ਆਪਣੇ ਹੱਥੀਂ ਅਸੀਂ ਕੱਪੜੇ ਧੋੋਂਦੇ ਹਾਂ ਅਤੇ ਫਿਰ ਨਹੀਂ ਤਾਂ ਫਿਰ ਮਸ਼ੀਨ ਨੂੰ ਸਪਿੰਨ ਕਰਕੇ ਡ ਡ੍ਰਾਈ ਕਰਕੇ ਕੱਪੜੇ ਸੁੱਕਣੇ ਪਾ ਕੇ ਫਿਰ ਉਹ ਹੀ ਪ੍ਰੋਸੀਜ਼ਰ ਅਸੀਂ ਤਹਿ ਲਾ ਕੇ ਪ੍ਰੈੱਸ ਕਰਕੇ ਅੰਦਰ ਰੱਖਦੇ ਹਾਂ ਐਡੀ ਸਰਦੀਆਂ ਵਿੱਚ ਸਰਦੀਆਂ ਵਿੱਚ ਸਾਡੇ ਪਾਣੀ ਨੂੰ ਅਸੀਂ ਠੰਡਾ ਜ਼ਿਆਦਾ ਹੁੰਦਾ ਹੈ ਕਰਕੇ ਫਿਰ ਅਸੀਂ ਮਸ਼ੀਨ ਲਾਉਂਦੇ ਹਾਂ ਜਿਸ ਕਰਕੇ ਸਾਡੇ ਹੱਥ ਜਿਹੇ ਤਾਂ ਸੁੰਨ ਹੋ ਜਾਂਦੇ ਕਿਉਂਕਿ ਮਸ਼ੀਨ 'ਚ ਥੋੜ੍ਹਾ ਜਿਹਾ ਫ਼ਰਕ ਪੈ ਜਾਂਦਾ ਡ੍ਰਾਈ ਕੱਪੜੇ ਕਰਨ ਨਾਲ਼ ਅਤੇ ਕਿਉਂਕਿ ਸਾਰਾ ਦਿਨ ਧੁੱਪ ਨਿਕਲਦੀ ਹੈ ਨਹੀਂ ਆ ਧੁੰਦਾਂ ਪੈਂਦੀਆਂ ਰਹਿੰਦੀਆਂ ਸਰਦੀ ਜ਼ਿਆਦਾ ਹੁੰਦੀ ਆ ਕੱਪੜੇ ਸੁੱਕਣ ਨੂੰ ਵੀ ਟਾਇਮ ਲੱਗ ਜਾਂਦਾ ਆ ਕਿਉਂਕਿ ਧੁੱਪਾਂ ਹੁੰਦੀਆਂ ਨਹੀਂ ਜੇ ਆਪਾਂ ਮਸ਼ੀਨ 'ਚ ਡ੍ਰਾਈ ਕਰਾਂਗੇ ਤਾਂ ਜਲਦੀ ਤੋਂ ਜਲਦੀ ਕੱਪੜੇ ਸੁੱਕਣਗੇ ਆ ਟਾਈਮ ਲੱਗਦਾ ਪਰ ਸੁੱਕ ਜਾਂਦੇ ਆ ਫਿਰ ਆਪਾਂ ਉਹਨੂੰ ਜਿੰਨੀ ਧੁੱਪ ਲੱਗੇ ਉਹਨੂੰ ਗਰਮ ਉਹ ਕਰ ਉਹ ਕਰਕੇ ਪ੍ਰੈੱਸ ਪਰੁਸ ਕਰਕੇ ਤਹਿ ਲਾ ਕੇ ਅਲਮਾਰੀ ਵਿੱਚ ਰੱਖਦੇ ਹਾਂ